ਹੈਲੋ ਹਾਂਜੀ ਜੀ ਸਾਡਾ ਬੱਚਾ ਸੀ ਬੀ ਐਸ ਈ ਦੇ ਵਿੱਚ ਹੈ ਜੀ

ਹਾਂ ਹਾਂ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਮੈਂ ਕੁਛ ਚੀਜ਼ਾਂ ਨੇ ਜਿਹੜੀਆਂ ਸੀ ਬੀ ਐਸ ਈ ਦੇ ਵਿੱਚ ਡਿਫੀਕਲਟ ਨੇ ਥੋੜ੍ਹੀਆਂ ਜਿਹੀਆਂ ਟਫ ਰਹਿ ਜਾਂਦੀਆਂ ਔਰ ਕਈ ਵਾਰੀ ਤਾਂ ਇਹ ਵੀ ਲੱਗਦਾ ਕਿ ਵੀ ਅਸੀਂ ਬੱਚਿਆਂ ਨਾਲ ਅਨਿਆ ਤਾਂ ਨਹੀਂ ਕਰ ਰਹੇ ਕਿਤੇ ਕਿਉਂਕਿ ਇਹਨਾਂ ਨੂੰ ਜਦੋਂ ਪੇਪਰ ਹੁੰਦੇ ਹੈ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਬੁੱਕ ਦੇ ਵਿੱਚੋਂ ਹੀ ਕਓਸ਼ਨਸ ਆਉਣ ਕਓਸ਼ਨ ਪੇਪਰ 'ਚ ਹਾਂਜੀ ਅਤੇ ਇਹਦੇ ਮਤਲਬ ਦਸ ਪੰਦਰਾਂ ਪਰਸੈਂਟ ਆ ਜਾਂਦੇ ਹੈ ਚਲੋ ਵੀਹ ਪਰਸੈਂਟ ਅਸੀਂ ਮੰਨਦੇ ਹਾਂ ਵੱਧ ਤੋਂ ਵੱਧ ਹੈ ਨਾ ਅਤੇ ਬਾਕੀ ਬੱਚੇ ਨੂੰ ਤਿਆਰੀ ਕਰਨੀ ਪੈਂਦੀ ਆ ਇਹਦਾ ਇੱਕ ਚੰਗਾ ਪੱਖ ਵੀ ਹੈਗਾ ਮਾੜਾ ਪੱਖ ਵੀ ਹੈਗਾ ਦੋਨੋਂ ਹੀ ਹੈ ਇਹਦੇ ਤਾਂ ਤੁਸੀਂ ਦੱਸੋਂ ਤੁਸੀਂ ਕਿਹੜੇ ਹਾਂ ਉਹਦਾ ਕਾਰਨ ਕੁਛ ਤਾਂ ਇਹ ਹਾਂਜੀ ਹਾਂਜੀ ਹਾਂਜੀ ਉਹ ਫਿਰ ਇਸ ਤਰ੍ਹਾਂ ਮੈਨੂੰ ਤਾਂ ਲੱਗਦਾ ਇਹਦਾ ਕਾਰਨ ਇਹੀ ਹੋ ਸਕਦਾ ਹੈ ਹਾਂ ਕਿਉਂਕਿ ਸੀ ਬੀ ਐਸ ਈ ਜੋ ਹੈ ਕਿਉਂਕਿ ਉਹ ਸੈਂਟਰਲ ਬੋਰਡ ਹੈ ਤਾਂ ਉਹ ਥੋੜ੍ਹਾ ਜਿਹਾ ਨੈਸ਼ਨਲਵਾਈਡ ਸੋਚਦੇ ਹੈ ਉਹ ਇੰਡੀਆ ਲੈਵਲ ਦੇ ਉੱਤੇ ਸੋਚਦੇ ਹੈ ਗੱਲ ਨੂੰ ਨਾਲ ਕਿ ਬੱਚੇ ਨੂੰ ਪਰਪੇਅਰ ਕਰਨਾ ਇੰਡੀਆ ਲੇਵਲ ਦੇ ਉੱਤੇ ਇੱਕ ਪਾਸੇ ਇਹ ਅਜੇ ਇੱਕ ਪਾਸੇ ਮੈਨੂੰ ਲੱਗਦਾ ਉਹ ਸਟੇਟ ਦੀ ਜ਼ਿੰਮੇਵਾਰੀ ਹੈ ਕਿਉਂਕਿ ਪੀ ਐਸ ਈ ਬੀ ਹੈ ਅਤੇ ਉਹ ਉਹਨਾਂ ਨੇ ਬੱਚਾ ਉਸ ਤਰੀਕੇ ਨਾਲ ਪਰਪੇਅਰ ਕਰਵਾਉਣਾ ਹੈ ਨਾ ਆਪਦੇ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਜ਼ਿਆਦਾ ਜੁੜੇ ਹੋਏ ਹਾਂ ਬੱਚਿਆਂ ਦੀ ਅਸਲੀਅਤ ਦੇ ਨਾਲ ਜਾਂ ਉਹਨਾਂ ਦੀ ਮੂਲ ਪਰਵਿਰਤੀ ਜੋ ਹੈ ਹਾਂ ਇਹ ਚੀਜ਼ ਦਾ ਤਾਂ ਜ਼ਰੂਰ ਹੈ ਕਿਉਂਕਿ ਇਹਨਾਂ ਨੂੰ ਇੱਕ ਇਹ ਬੈਨੀਫਿਟ ਮਿਲ ਜਾਂਦਾ ਹੈ ਕਿਉਂਕਿ ਉਹ ਮੇਰੇ ਖਿਆਲ ਹੈ ਕਿ ਹਰ ਸਟੇਟ ਵਿੱਚ ਹੀ ਹੈ ਸ਼ਾਇਦ ਉਹ ਗੱਲ ਅਤੇ ਜਦੋਂ ਅਸੀਂ ਉਹਨਾਂ ਨੂੰ ਮਤਲਬ ਜਦੋਂ ਜੋਬ ਦੀ ਗੱਲ ਆਉਂਦੀ ਹੈ ਤਾਂ ਉਹ ਆਪਦੇ ਹੀ ਜਿਹੜੇ ਬੋਰਡ ਹੈ ਹੈ ਨਾ ਜਿਹੜੇ ਸਟੇਟ ਦੇ ਕਹਿ ਦਓ ਉਹਨਾਂ ਨੂੰ ਪ੍ਰੈਫਰਸ ਦਿੰਦੇ ਹੈ ਉਹ ਇੱਥੇ ਆ ਕੇ ਜਿਹੜਾ ਹੈ ਸੀ ਬੀ ਐਸ ਈ ਵਾਲੇ ਬੱਚਿਆਂ ਨੂੰ ਥੋੜ੍ਹਾ ਜਿਹਾ ਘਾਟਾ ਵੀ ਖਾਣਾ ਪੈਂਦਾ ਹੈ ਹਾਂ ਹਾਂ ਨੈਸ਼ਨਲਵਾਈਡ ਅਗਰ ਕੋਈ ਚੀਜ਼ ਹੁੰਦੀ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਜ਼ਰੂਰ ਬੈਨੀਫਿਟ ਮਿਲ ਜਾਂਦਾ ਚਾਹੇ ਉਹ ਕੋਪੀਟੀਸ਼ਨ ਦਾ ਇਗਜ਼ਾਮ ਹੈ ਜਾਂ ਕੋਈ ਹੋਰ ਦੂਸਰਾ ਉਹਨਾਂ ਨੇ ਅੱਗੇ ਪੜ੍ਹਨਾ ਹੈ ਜਾਂ ਜੋਬ ਲੈਣੀ ਹੈ ਨੇ ਅਗਰ ਕੋਈ ਇੰਡੀਆ ਲੇਵਲ ਦੀ ਹੈ ਤਾਂ ਇਸ ਤਰ੍ਹਾਂ ਨਾਲ ਬੈਨੀਫਿਟ ਮਿਲ ਜਾਂਦਾ ਬਾਕੀ ਜੀ ਦੇਖ ਜੀ ਜੀ ਓਕੇ ਜੀ ਓਕੇ ਜੀ ਓਕੇ ਇਟਸ ਓਲ ਰਾਈਟ ਇਟਸ ਮਾਈ ਪਲੈਸਰ ਟੂ ਟੋਕ ਟੂ ਯੂ